ਹਾਂਜੀ ਮੈਂ ਆਪਣੇ ਡਰਾਇੰਗ ਅਨਭਾਵ ਦਾ ਵੇ ਵਰਣਨ ਕਰ ਸਕਦੀ ਹਾਂ ਡਰਾਇੰਗ ਇੱਕ ਬੜੀ ਅਦਭੁਤ ਕਲਾ ਹੈ ਇਹ ਸਾਨੂੰ ਸਟਾਰਟਿੰਗ ਤੋਂ ਹੀ ਸਕੂਲ ਤੋਂ ਹੀ ਸਕੂਲ ਤੋਂ ਹੀ ਸਿਖਾਇਆ ਜਾਂਦਾ ਹੈ ਡਰਾਇੰਗ ਦਾ ਇੱਕ ਸਬਜੈਕਟ ਬਣਾਇਆ ਜਾਂਦਾ ਹੈ ਸਕੂਲ ਵਜੋਂ ਜੋ ਕਿ ਛੋਟੇ ਬੱਚਿਆਂ ਨੂੰ ਪ੍ਰੈਕਟਿਸ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਅਤੇ ਉਹ ਹੌਲੀ ਹੌਲੀ ਪ੍ਰੇਰਿਤ ਹੋ ਕੇ ਆਪਣੇ ਡਰਾਇੰਗ ਵਿੱਚ ਆਪਣੀ ਕਲਾ ਵਿੱਚ ਬਹੁਤ ਵਧੀਆ ਹੀ ਕਲਾਕਾਰ ਲਾਈਕ ਬਣ ਜਾਂਦੇ ਆ ਅਤੇ ਮੈਨੂੰ ਵੀ ਮੈਨੂੰ ਵੀ ਮੇਰੇ ਅਧਿਆਪਕਾਂ ਨੇ ਹੀ ਇਸ ਚੀਜ਼ ਲਈ ਪ੍ਰੇਰਿਤ ਕੀਤਾ ਹੈ ਮੈਨੂੰ ਵੀ ਡਰਾਇੰਗ ਵਿੱਚ ਬਹੁਤ ਦਿਲ ਦਿਲਚਸਪੀ ਹੈ ਮੈਂ ਲਾਈਕ ਮਹਿੰਦੀ ਡਿਜ਼ਾਇਨ ਵੀ ਡਿਜ਼ਾਇਨ ਕਰ ਲੈਂਦੀ ਹਾਂ ਜੋ ਕਿ ਇੱਕ ਡਰਾਇੰਗ ਦਾ ਹੀ ਹਿੱਸਾ ਹੈ ਡਰਾਇੰਗ ਇੱਕ ਬਹੁਤ ਅੱਛੀ ਕਲਾ ਹੈ ਜੋ ਸਭ ਨੂੰ ਹੀ ਆਉਣੀ ਚਾਹੀਦੀ ਹੈ